ਹੈਲੋ ਮੈਨੂੰ ਜੀ ਆਪਣੇ ਘੁੰਮਣ ਫਿਰਨੇ ਦਾ ਸ਼ੌਕ ਹੈਗਾ ਜੀ ਅਤੇ ਮੈਂ ਇੱਕ ਵਾਰ ਇੱਧਰ ਆਪਣੇ ਸਾਊਥ ਵੱਲ ਚਲੇ ਗਿਆ ਜੀ ਘੁੰਮਣ ਫਿਰਨ ਵਾਸਤੇ ਅਤੇ ਉੱਧਰ ਜਾ ਕੇ ਜੀ ਮੈਨੂੰ ਫਿਰ ਅਸੀਂ ਪੰਜਾਬ ਚ ਰਹਿਣ ਕਰਕੇ ਪੰਜਾਬੀ ਬੋਲੀ ਹੀ ਜ਼ਿਆਦੇ ਆਉਂਦੀ ਹੈ ਜੀ ਜਾਂ ਫਿਰ ਇੰਗਲਿਸ਼ ਦਾ ਜੀ ਮਾੜਾ ਮੋਟਾ ਅਤੇ ਉੱਥੇ ਜਾਣ ਕਰਕੇ ਸਾਨੂੰ ਬੋਲੀ ਦੀ ਦਿੱਕਤ ਆਉਣ ਕਰਕੇ ਪਤਾ ਹੀ ਨਾ ਲੱਗੇ ਜੋ ਬੱਸਾਂ 'ਤੇ ਲਿਖਿਆ ਸੀ ਉਹ ਵੀ ਨਹੀਂ ਸੀ ਪਤਾ ਲੱਗਦਾ ਜੀ ਜੋ ਹੋਰ ਉੱਪਰ ਸਾਈਨ ਵਗੈਰਾ ਹੁੰਦੇ ਸੀ ਉਹਦੇ ਬਾਰੇ ਵੀ ਕੋਈ ਜਾਣਕਾਰੀ ਖਾਸ ਕੋਈ ਸਮਝ ਨਹੀਂ ਸੀ ਆ ਰਹੀ ਤੇ ਫਿਰ ਮੈਂ ਆਪਣੇ ਕਿਸੇ ਦੋਸਤ ਨੂੰ ਫ਼ੋਨ ਕਰਕੇ ਪੁੱਛਿਆ ਬਈ ਇਸ ਬਾਰੇ ਬਈ ਮੈਨੂੰ ਤਾਂ ਇਹਨਾਂ ਦੀ ਬੋਲੀ ਬਾਰੇ ਪਤਾ ਹੀ ਨਹੀਂ ਲੱਗਦਾ ਅਤੇ ਮੈਂ ਕਿਸ ਤਰ੍ਹਾਂ ਇਹਦੇ ਵਿੱਚ ਸਫਲ ਹੋ ਸਕਦਾ ਹਾਂ ਤਾਂ ਉਹਨਾਂ ਨੇ ਫਿਰ ਮੈਨੂੰ ਫ਼ੋਨ 'ਤੇ ਗੂਗਲ ਤੋਂ ਟ੍ਰਾਂਸਲੇਸ਼ਨ ਕਰਨ ਬਾਰੇ ਦੱਸਿਆ ਅਤੇ ਉਹਨਾਂ ਦੇ ਦੱਸਣ ਮੁਤਾਬਕ ਫਿਰ ਮੈਂ ਵਰਲਡਿੰਗ ਜਿਹੜੀ ਸੀ ਉਹਨੂੰ ਗੂਗਲ 'ਤੇ ਪਾ ਕੇ ਉਹਦੇ ਤੋਂ ਚੈੱਕ ਕਰਕੇ ਜਵਾਬ ਲੈ ਲੈਂਦਾ ਸੀ ਅਤੇ ਇਸ ਤਰ੍ਹਾਂ ਗੂਗਲ ਨੇ ਮੈਨੂੰ ਕਾਫੀ ਸੁਖਾਲਾ ਕਰ ਦਿੱਤਾ ਇਹਦੇ ਵਿੱਚ ਅਤੇ ਜਿਹੜੀ ਵੀ ਚੀਜ਼ ਕੋਈ ਮੈਂ ਲੈਣੀ ਹੁੰਦੀ ਸੀ ਉੱਥੇ ਕੋਈ ਖਾਣ ਪੀਣ ਵਾਲੀ ਉਸਦੀ ਵੀ ਫੋਟੋ ਖਿੱਚਦਾ ਅਤੇ ਖਿੱਚ ਕੇ ਗੂਗਲ 'ਤੇ ਪਾ ਕੇ ਉਹਦੀ ਜਾਣਕਾਰੀ ਦਾ ਜਵਾਬ ਜੋ ਆ ਜਾਂਦਾ ਸੀ ਉਸ ਤੋਂ ਫਿਰ ਮੈਂ ਉਹ ਚੀਜ਼ ਵੀ ਖਰੀਦ ਲੈਂਦਾ ਸੀ ਅਤੇ ਇਸ ਕਰਕੇ ਮੇਰੇ ਦੋਸਤ ਤੋਂ ਲਈ ਹੋਈ ਜਾਣਕਾਰੀ ਅੱਜ ਦੇ ਵਿਗਿਆਨਕ ਯੁਗ ਹੋਣ ਕਰਕੇ ਗੂਗਲ ਨੇ ਕਾਫੀ ਸਾਰਥਕ ਬਣਾ ਕੇ ਮੇਰੀ ਮਦਦ ਕੀਤੀ